ਇੱਕ ਜਨਵਰੀ ਦੋ ਹਜ਼ਾਰ ਪੰਜ ਤੇਰ੍ਹਾਂ ਅਗਸਤ ਦੋ ਹਜ਼ਾਰ ਪੰਜ ਇੱਕ ਅਪ੍ਰੈਲ ਉੱਨੀ ਸੌ ਸੰਤਾਲੀ ਤੇਰ੍ਹਾਂ ਅਕਤੂਬਰ ਦੋ ਹਜ਼ਾਰ ਸੌਲ੍ਹਾਂ ਤੇਈ ਮਈ ਦੋ ਹਜ਼ਾਰ ਸੱਤ